ਪੰਜਾਬੀ ਭਾਸ਼ਾ ਅੰਗਰੇਜ਼ੀ ਅਤੇ ਸੰਸਕ੍ਰਿਤ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿੱਚ ਵੀ ਤਕਰੀਬਨ ਬੰਦ ਏ ਕਰ ਤਾ ਅੰਗਰੇਜ਼ੀ ਬੋਲਦੇ ਆ ਜਾਂ ਸੰਸਕ੍ਰਿਤ ਹੀ ਬੋਲਦੇ ਆ ਇਸ ਕਾਰਨ ਨਾਲ ਪੰਜਾਬੀ ਭਾਸ਼ਾ 'ਤੇ ਬਹੁਤ ਮਾੜਾ ਅਸਰ ਹੋਇਆ ਬੱਚੇ ਪੰਜਾਬੀ ਬੋਲਣਾ ਸਕੂਲਾਂ ਦੇ ਵਿੱਚ ਬਿਲਕੁਲ ਹੀ ਭੁੱਲ ਗਏ ਉਹਨਾਂ ਨੂੰ ਅੰਗਰੇਜ਼ੀ ਵਿੱਚ ਜਾਂ ਸੰਸਕ੍ਰਿਤ ਵਿੱਚ ਵੀ ਗੱਲ ਕਰਨ ਲਈ ਕਿਹਾ ਜਾਂਦਾ ਹੈ ਅਤੇ ਲਿਖਣਾ ਵੀ ਅੰਗਰੇਜ਼ੀ ਜਾਂ ਸੰਸਕ੍ਰਿਤ ਵਿੱਚ ਹੀ ਸਿਖਾਇਆ ਗਿਆ ਹੈ ਇਸ ਕਰਕੇ ਪੰਜਾਬੀ ਭਾਸ਼ਾ ਜਿਹੜੀ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ